ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ

ਹਾਂਜੀ ਜ਼ਰੂਰ ਕਿੱਥੋਂ ਦੇ ਚਾਹੀਦੇ ਨੇ ਅੰਮ੍ਰਿਤਸਰ ਦੇ ਜਾਂ ਪੂਰੇ ਪੰਜਾਬ ਦੇ ਠੀਕ ਹੈ ਹਾਂਜੀ ਹਾਂਜੀ ਇੱਕ ਤਾਂ ਤੁਹਾਨੂੰ ਪਤਾ ਹੀ ਹੈ ਹਾਂਜੀ ਇੱਕ ਤਾਂ ਤੁਹਾਨੂੰ ਪਤਾ ਹੀ ਹੈ ਜਿਵੇਂ ਗੋਲਡਨ ਟੈਂਪਲ ਆਪਣਾ ਹਰਿਮੰਦਰ ਸਾਹਿਬ ਹਾਂ ਉਹਦੇ ਨਾਲ਼ ਹੀ ਬਾਬਾ ਅਟੱਲ ਰਾਏ ਸਾਹਿਬ ਦਾ ਗੁਰਦੁਆਰਾ ਹੈ ਅਤੇ ਨਾਲ਼ ਹੀ ਅਗਾਂਹ ਫਿਰ ਬਾਬਾ ਸ਼ਹੀਦਾਂ ਸਾਹਿਬ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਹੈ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਇੱਕ ਇੱਥੇ ਇੱਕ ਹੋਰ ਬਾਬਾ ਦੀਪ ਸਿੰਘ ਜੀ ਦਾ ਨਵਾਂ ਗੁਰਦੁਆਰਾ ਬਣਿਆ ਟਾਲਾ ਸਾਹਿਬ ਅਤੇ ਹਾਂਜੀ ਇੱਕ ਬਾਬਾ ਬੁੱਢਾ ਜੀ ਦਾ ਗੁਰਦੁਆਰਾ ਹੈ ਬੀੜ ਸਾਹਿਬ ਉਸ ਤੋਂ ਹਾਂਜੀ ਨਹੀਂ ਅੰਮ੍ਰਿਤਸਰ ਵਿੱਚ ਹੀ ਹੈ ਫਿਰ ਉਹ ਡਿਸਟ੍ਰਿਕਟ ਚੇਂਜ ਕਰ ਦਿੱਤੀ ਹੋਏਗੀ ਤਾਂ ਮੈਂਨੂੰ ਇੱਕ ਛੇਹਰਟਾ ਸਾਹਿਬ ਹੈ ਹਾਂਜੀ ਉਹ ਗੁਰੂ ਕੀ ਬਡਾਲੀ ਗੁਰਦੁਆਰਾ ਹੈ ਛੇਵੇਂ ਪਾਤਸ਼ਾਹ ਜੀ ਦਾ ਜਨਮ ਅਸਥਾਨ ਬਾਸਰਕੇ ਗੁਰਦੁਆਰਾ ਹੈ ਹਾਂਜੀ ਹਾਂਜੀ ਹਾਂਜੀ ਤਰਨਤਾਰਨ ਤੂਤ ਸਾਹਿਬ ਹੈ ਇੱਧਰੋਂ ਹਾਂਜੀ ਸੰਨ ਸਾਹਿਬ ਹੋ ਗਿਆ ਬਾਸਰਕੇ ਪਿੰਡ ਵਿੱਚ ਇੱਕ ਗੁਰਦੁਆਰਾ ਸਾਹਿਬ ਹੈ ਗੁਰੂ ਰਾਮਦਾਸ ਗੁਰੂ ਅਮਰਦਾਸ ਜੀ ਦਾ ਹੋਰ ਦੱਸੋ ਹੋਰ ਕਿਹੜੇ ਗੁਰਦੁਆਰੇ ਬਾਰੇ ਪੁੱਛਣਾ ਤੁਸੀਂ ਹਾਂਜੀ ਓ ਓਕੇ ਥੈਂਕ ਯੂ ਥੈਂਕ ਯੂ